ਇਸ ਖੇਤਰ ਦੇ ਲੋਕ ਆਪਣੇ ਧਰਮ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਤਰ੍ਹਾਂ ਪਹੁੰਚਾਉਂਦੇ ਹਨ ਕਿ ਜਦੋਂ ਵੀ ਉਨ੍ਹਾਂ ਦੇ ਬੱਚੇ ਛੋਟੇ ਹੁੰਦੇ ਹਨ ਉਨ੍ਹਾਂ ਦੇ ਕੋਲ ਬੈਠਦੇ ਹਨ ਤਾਂ ਉਹ ਆਪਣੇ ਧਰਮ ਦੇ ਬਾਰੇ ਉਨ੍ਹਾਂ ਨੂੰ ਦੱਸਦੇ ਹਨ ਕਿ ਅਸੀਂ ਇਸ ਧਰਮ ਦੇ ਹਾਂ ਸਾਡੇ ਗੁਰੂ ਆ ਆ ਹੈਗੇ ਸੀਗੇ ਅਤੇ ਇਹ ਸਾਡੇ ਗੁਰੂ ਦਾ ਨਾਂ ਆ ਵਾਲਾ ਸੀਗਾ ਇਨ੍ਹਾਂ ਦੀ ਪੁੱਤਰ ਆ ਸੀਗਾ ਇਨ੍ਹਾਂ ਦੇ ਗੜੀ ਫਿਰ ਆ ਇੱਦਾਂ ਹੋਏ ਫਿਰ ਉਨ੍ਹਾਂ ਨੇ ਇਹ ਇਹ ਚੀਜ਼ਾਂ ਕੀਤੀਆਂ ਸਾਰੀਆਂ ਇਹ ਵਾਲੀਆਂ ਅਤੇ ਹੋਰ ਤਾਂ ਹੋਰ ਫਿਰ ਉਨ੍ਹਾਂ ਨੂੰ ਆਪਣੇ ਧਾਰਮਿਕ ਸਥਾਨ ਜਿੱਥੇ ਵੀ ਹੋਵੇ ਉਨ੍ਹਾਂ ਦਾ ਜੇ ਕੋਈ ਹਿੰਦੂ ਹੋਵੇ ਤਾਂ ਉਨ੍ਹਾਂ ਨੂੰ ਮੰਦਰ ਲੈ ਕੇ ਜਾਂਦੇ ਆ ਜੇ ਕੋਈ ਮੁਸਲਿਮ ਹੋਵੇ ਤਾਂ ਉਨ੍ਹਾਂ ਨੂੰ ਮਸਜਿਦ 'ਚ ਲੈ ਕੇ ਜਾਂਦੇ ਆ ਜੇ ਕੋਈ ਸਿੱਖ ਹੋਵੇ ਤਾਂ ਉਨ੍ਹਾਂ ਨੂੰ ਗੁਰਦੁਆਰੇਰੇ ਲੈ ਕੇ ਜਾਂਦੇ ਆ ਅਤੇ ਅਤੇ ਉੱਥੇ ਜਾ ਕੇ ਉਨ੍ਹਾਂ ਦੇ ਜੋ ਵੀ ਜੋ ਵੀ ਉਹ ਬਾਣੀ ਵਗੈਰਾ ਪੜ੍ਹਦੇ ਨੇ ਸੁਣਦੇ ਨੇ ਅਤੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਰਥਾਂ ਬਾਰੇ ਦੱਸਦੇ ਨੇ ਕਿ ਸਾਡੀ ਬਾਣੀ ਵਿੱਚ ਆ ਹੈ ਚੀਜ਼ਾਂ ਲਿਖੀਆਂ ਵਾ ਇਹ ਬਾਣੀ ਸਾਡੇ ਇਸ ਗੁਰੂ ਨੇ ਲਿਖੀ ਸੀ ਅਤੇ ਇਸ ਗੁਰੂ ਨੇ ਇਸ ਬਾਣੀ ਵਿੱਚ ਐਹ ਐਹ ਚੀਜ਼ਾਂ ਲਿਖੀਆਂ ਸੀ ਸਾਡੇ ਗੁਰੂ ਇੱਥੇ ਇੱਥੇ ਹੋ ਕੇ ਆਏ ਨੇ ਐਹ ਚੀਜ਼ਾਂ ਕੀਤੀਆਂ ਨੇ ਅਤੇ ਹੋਰ ਵੀ ਉਨ੍ਹਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਪੁਰਾਣੀਆਂ ਪੁਰਾਤਨ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਉਨ੍ਹਾਂ ਬਾਰੇ ਦਿਖਾਉਂਦੇ ਨੇ ਮੂਰਤੀਆਂ ਵਗੇਰਾ ਦਿਖਾਉਂਦੇ ਨੇ ਅਤੇ ਜਿਹੜੇ ਉਨ੍ਹਾਂ ਦੇ ਗ੍ਰੰਥ ਨੇ ਉਨ੍ਹਾਂ ਨੂੰ ਗ੍ਰੰਥਾਂ ਨਾਲ ਦਿਖਾਉਂਦੇ ਨੇ ਅਤੇ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ ਕਿ ਸਾਨੂੰ ਆਪਣੇ ਗ੍ਰੰਥ ਪੜ੍ਹਨੇ ਚਾਹੀਦੇ ਹਨ ਸਾਡੇ ਗੁਰੂਆਂ ਨੂੰ ਇਹੀ ਹੁਕਮ ਹੋਇਆ ਹੈ ਕਿ ਸਾਨੂੰ ਆਪਣੇ ਗ੍ਰੰਥਾਂ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਉਨ੍ਹਾਂ ਵਿੱਚ ਲਿਖੀਆਂ ਗੱਲਾਂ ਸਾਰੀਆਂ 'ਤੇ ਅਮਲ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਜੀਵਨ